ਸਭ ਤੋਂ ਚੁਣੌਤੀਪੂਰਨ ਰੂਟ ਮੇਰੇ ਸਾਈਕਲ 'ਤੇ ਜਿਹੜਾ ਮੈਂ ਕੱਟਿਆ ਹੈ ਉਹ ਮੇਰਾ ਮੇਰੇ ਘਰ ਤੋਂ ਲੈ ਕੇ ਮੇਰੇ ਸਕੂਲ ਤੱਕ ਦਾ ਸੀ ਕਿਉਂਕਿ ਉਹ ਬਹੁਤ ਲੰਬਾ ਰਸਤਾ ਸੀ ਲਗਭਗ ਵੀਹ ਕੁ ਕਿਲੋਮੀਟਰ ਦਾ ਰਸਤਾ ਹੁੰਦਾ ਸੀ ਅਤੇ ਮੈਨੂੰ ਸਾਈਕਲ 'ਤੇ ਜਾਣਾ ਪੈਂਦਾ ਸੀ ਧੁੱਪ ਗਰਮੀ ਠੰਡ ਚਾਹੇ ਜੋ ਮਰਜ਼ੀ ਹੋਵੇ ਮੈਨੂੰ ਹਰ ਮੌਸਮ ਵਿੱਚ ਆਪਣੀ ਸਾਈਕਲ 'ਤੇ ਆਪਣੇ ਸਕੂਲ ਜਾਣਾ ਪੈਂਦਾ ਸੀ ਅਤੇ ਕਈ ਵਾਰ ਤਾਂ ਇੱਦਾਂ ਹੁੰਦਾ ਸੀ ਕਿ ਮੈਂ ਸਾਈਕਲ 'ਤੇ ਜਾ ਰਿਹਾ ਅਤੇ ਵਿੱਚ ਰਸਤੇ ਵਿੱਚ ਮੇਰੀ ਸਾਈਕਲ ਦਾ ਟਾਇਰ ਪੈਂਚਰ ਹੋ ਜਾਂਦਾ ਸੀ ਅਤੇ ਪੈਂਚਰ ਵਾਲੇ ਦੀ ਦੁਕਾਨ ਨੇੜੇ ਤੇੜੇ ਨਾ ਹੋ ਕਰਕੇ ਮੈਨੂੰ ਕਾਫੀ ਦੇਰ ਪੈਦਲ ਚੱਲ ਕੇ ਸਾਈਕਲ ਨੂੰ ਰੇੜਨਾ ਪੈਂਦਾ ਸੀ ਅਤੇ ਕਈ ਵਾਰ ਮੇਰਾ ਮਨ ਬਹੁਤ ਖ਼ਰਾਬ ਹੁੰਦਾ ਸੀ ਆਸ ਪਾਸ ਲੋਕਾਂ ਨੂੰ ਦੇਖ ਕੇ ਕਿਉਂਕਿ ਉਹ ਗੱਡੀਆਂ ਵਿੱਚ ਮੋਟਰਸਾਈਕਲਾਂ ਵਿੱਚ ਜਾਂਦੇ ਹੁੰਦੇ ਸੀ ਅਤੇ ਮੈਨੂੰ ਲੱਗਦਾ ਸੀ ਕਿ ਮੈਂ ਕਿੰਨਾ ਬਦਨਸੀਬ ਆ ਕਿ ਮੈਨੂੰ ਆਪਣੀ ਸਾਈਕਲ 'ਤੇ ਜਾਣਾ ਪੈ ਰਿਹਾ ਅਤੇ ਪਰ ਅੱਜ ਮੈਂ ਗ੍ਰੈਜੂਏਟ ਹੋ ਚੁੱਕਿਆ ਤਾਂ ਮੈਨੂੰ ਲੱਗਦਾ ਹੈ ਕਿ ਉਹ ਦਿਨ ਵੀ ਬਹੁਤ ਵਧੀਆ ਦਿਨ ਸੀ ਕਿਉਂਕਿ ਉਹਨਾਂ ਦਿਨਾਂ ਕਰਕੇ ਹੀ ਮੈਂ ਅੱਜ ਆਪਣੀ ਇਹ ਸਿੱਖਿਆ ਪ੍ਰਾਪਤੀ ਕੀਤੀ ਹੈ ਕਿ ਕੋਈ ਬੰਦਾ ਉੱਚਾ ਨੀਵਾਂ ਨਹੀਂ ਹੁੰਦਾ ਸਾਰਿਆਂ ਦੀ ਆਪਣੀ ਕਹਾਣੀ ਹੁੰਦੀ ਹੈ ਸਾਰੇ ਆਪਣੇ ਮਿਹਨਤ ਕਰਕੇ ਅੱਗੇ ਵੱਧਦੇ ਹਨ ਅਤੇ ਮੈਂ ਸਾਈਕਲ 'ਤੇ ਜਿੰਨਾ ਵੀ ਆ ਚਰਿਆ ਮੈਨੂੰ ਅਹਿਸਾਸ ਹੁੰਦਾ ਕਿ ਮੇਰੀ ਸਿਹਤ ਲਈ ਵੀ ਉਹ ਬਹੁਤ ਵਧੀਆ ਹੁੰਦਾ ਸੀਗਾ ਇਸ ਕਰਕੇ ਮੈਂ ਉਸ ਰੂਟ 'ਤੇ ਉਹੀ ਮੇਰਾ ਚੁਣੌਤੀਪੂਰਨ ਰੂਟ ਸੀ ਜੋ ਵੀਹ ਕੁ ਕਿਲੋਮੀਟਰ ਦਾ ਹੁੰਦਾ ਸੀ